ਹਾਂਜੀ ਹੋਰ ਠੀਕ ਠਾਕ ਹੋ ਮੈਂਬਰ ਸਾਹਿਬ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਆ ਸਭ ਠੀਕ ਆ ਅਤੇ ਆਪਾਂ ਨੇ ਨਾ ਕੁਛ ਜ਼ਰੂਰੀ ਗੱਲਾਂ ਕਰਨੀਆਂ ਸੀ ਪਿੰਡ ਪੱਧਰ 'ਤੇ ਅਤੇ ਇੱਕ ਤਾਂ ਆਪਣੀ ਜਿਹੜੀ ਮੋਟਰ ਆ ਪਾਣੀ ਵਾਲੀ ਉ ਉਹ ਕਾਫੀ ਚਿਰ ਤੋਂ ਹਾਂਜੀ ਹਾਂਜੀ ਇਹ ਬਸ ਤੁਹਾਨੂੰ ਪਤਾ ਹੀ ਆ ਉਹ ਪਾ ਇੱਕ ਪਾਣੀ ਵੀ ਸਾਫ ਨਹੀਂ ਆ ਰਿਹਾ ਠੀਕ ਹੈ ਹਾਂਜੀ ਹਾਂਜੀ ਉਹ ਆਪਾਂ ਕਿਸੇ ਦਿਨ ਹਾਂਜੀ ਠੀਕ ਹੈ ਠੀਕ ਠੀਕ ਠੀਕ ਹਾਂਜੀ ਬ ਬਸ ਠੀਕ ਆ ਬਾਕੀ ਟੋਭੇ ਦੀ ਸਫਾਈ ਦਾ ਤੁਹਾਨੂੰ ਪਤਾ ਹੋਣਾ ਵੀ ਟੋਭੇ ਸਫਾਈ ਕਰਵਾਉਣ ਆਲੀ ਆ

ਬਿਲਕੁਲ ਇੱਕ ਮੈਂਬਰ ਇੱਕ ਠੀਕ ਆ ਇੱਕ ਮੈਂਬਰ ਸਾਹਿਬ ਨਾ ਇੱਕ ਜਿਹੜੀ ਨਾਲੀਆਂ ਨੇ ਨਾਲੀਆਂ ਦੀ ਵੀ ਆਪਣੇ ਕਾਫੀ ਪਾਣੀ ਖੜ੍ਹਨ ਲੱਗ ਗਿਆ ਇਹਨਾਂ ਦੀ ਵੀ ਸਫਾਈ ਦਾ ਧਿਆਨ ਦਿਉ ਠੀਕ ਆ ਠੀਕ ਹਾਂ ਇੱਕ ਆਪਾਂ ਨਾ ਇੱਕ ਹੋਰ ਧਿਆਨ ਰੱਖਿਉ ਜਿਹੜੀਆਂ ਆਪਣੇ ਗਲੀ ਦੀਆਂ ਲਾਈਟਾਂ ਨੇ ਇਹਨਾਂ ਦੀ ਰੋਸ਼ਨੀ ਬੜੀ ਘੱਟ ਗਈ ਆ ਵੀ ਇਹਨਾਂ ਦਾ ਕੀ ਤੁਸੀਂ ਦੱਸੋਗੇ ਕੀ ਕਰੀਏ ਆਪਾਂ ਕੋਈ ਮਤਾ ਪਾ ਕੇ ਨਾ ਆਪਾਂ ਮਤਾ ਪਾ ਕੇ ਆਪਾਂ ਕੋਈ ਇਹਨਾਂ ਦੀ ਇਹਦੇ ਸੰਬੰਧ 'ਚ ਗਰਾਂਟ ਲਈਏ ਉਹਨਾਂ ਤੋਂ ਆਪਾਂ ਇੱਕ ਨਾ ਆਪਣੇ ਜਿਹੜਾ ਘਾਹ ਫੂਸ ਆ ਬ ਸੜਕ ਦੁਆਲੇ ਵੀ ਗਲੀਆਂ ਦੇ ਨਾਲ ਵੀ ਇੱਕ ਮੈਂਬਰ ਸਾਹਿਬ ਮੈਂ ਹੋਰ ਸੋਚ ਰਿਹਾ ਸੀ ਜਿਵੇਂ ਨਾ ਆਪਣੇ ਗਲੀਆਂ ਨਾਲੀਆਂ ਨੇ ਵੀ ਹੁਣ ਮੈਂ ਕਹਿੰਦਾ ਵੀ ਇਹਨਾਂ ਦਾ ਆਪਾਂ ਨਾ ਜਿਹੜਾ ਪ੍ਰੋਬਲਮ ਆ ਰਹੀ ਆ ਆਪਾਂ ਇਹਦਾ ਸੀਵਰੇਜ ਸਿਸਟਮ ਬਾਰੇ ਕੋਈ ਐਪਲੀਕੇਸ਼ਨ ਮਤਾ ਪਾ ਕੇ ਇਹਦਾ ਆਪਾਂ ਗਰਾਂਟ ਲਈ ਭੇਜੀਏ ਬਸ ਇਹ ਚੀਜ਼ਾਂ ਨਾ ਬੜੀਆਂ ਧਿਆਨ 'ਚ ਰੱਖਣ ਵਾਲੀਆਂ ਨੇ ਆਪਾਂ ਪਿੰਡ ਦੀ ਬਿਹਤਰੀ ਲਈ ਨਾ ਇਹ ਕੰਮ ਕਰੀਏ ਬਹੁਤ ਜਲਦ ਠੀਕ ਆ ਨਹੀਂ ਇਹ ਵੀ ਵਧੀਆ ਤੁਹਾਡਾ ਸੁਝਾਅ ਜਿਵੇਂ ਉੱਥੇ ਪਿੱਪਲ ਵਗੈਰਾ ਖੜ੍ਹਾ ਆਪਾਂ ਚੌਕ ਬਣਾ ਦੇਈਏ ਕਵਰ ਜਿਹਾ ਕਰਕੇ ਵਧੀਆ ਲੱਗਦਾ ਬੈਠਣ ਉੱਠਣ ਲਈ ਬਜ਼ੁਰਗਾਂ ਦੇ ਬੈਠਣ ਲਈ

ਠੀਕ ਠੀਕ ਠੀਕ ਚਲੋ ਇਹ ਸਾਰੀਆਂ ਗੱਲਾਂ ਨਾ ਆਪਾਂ ਰੱਖ ਕੇ ਮਤਾ ਪਾਸ ਕਰਕੇ ਆਪਾਂ ਕਰੀਏ ਹੱਲ ਇਹਦਾ ਓਕੇ ਓਕੇ ਜੀ ਓਕੇ ਧੰਨਵਾਦ ਬੰਦ ਕਰ ਦੇ